ਇਹ ਇੱਕ ਆਮ ਜਿਹੀ ਗੱਲ ਹੈ ਕਿ ਕਿਉਂਕਿ ਅਸੀਂ ਆਪਣੇ ਘਰ ਨੂੰ ਹਰ ਇੱਕ ਤਿਉਹਾਰ ਜਿਵੇਂ ਦਿਵਾਲੀ ਲੋਹੜੀ ਮੇਲੇ ਦੁਸਹਿਰੇ ਆਦਿ ਇਨ੍ਹਾਂ ਨੂੰ ਇਨ੍ਹਾਂ ਨੂੰ ਤਿਉਹਾਰਾਂ 'ਤੇ ਅਸੀਂ ਘਰ ਆਪਣਾ ਘਰ ਸਜਾਉਂਦੇ ਹਾਂ ਇਹ ਤਾਂ ਆਮ ਜਿਹੀ ਗੱਲ ਹੈ ਕਿ ਅਸੀਂ ਆਪਣੇ ਘਰ ਨੂੰ ਹਰ ਰੋਜ਼ ਸਜਾਉਂਦੇ ਹਾਂ ਅਸੀਂ ਵਿਆਹ ਸ਼ਾਦੀਆਂ ਵਿੱਚ ਘਰ ਨੂੰ ਰੰਗ ਕਰਕੇ ਉਸਨੂੰ ਦੀਪਮਾਲਾ ਪਾ ਕੇ ਸਜਾਉਂਦੇ ਹਾਂ ਜਿਸ ਨਾਲ ਘਰ ਦੀ ਚਮਕ ਵੱਖਰੀ ਹੋ ਜਾਂਦੀ ਹੈ ਜੋ ਕਿ ਹਰ ਇੱਕ ਨੂੰ ਦੇਖਣ ਵਿੱਚ ਸੋਹਣਾ ਲੱਗਦਾ ਹੈ ਘਰ ਨੂੰ ਅਸੀਂ ਇਸ ਤਰ੍ਹਾਂ ਵੀ ਸਜਾ ਸਕਦੇ ਹਾਂ ਜਿਵੇਂ ਰੰਗੋਲੀ ਬਣਾਕੇ ਦੀਪਮਾਲਾ ਪਾ ਕੇ ਅਤੇ ਘਰ ਨੂੰ ਕਲਰਫੁੱਲ ਬਣਾਇਆ ਜਾਂਦਾ ਹੈ ਜਿਸ ਨਾਲ ਘਰ ਸੋਹਣਾ ਲੱਗਦਾ ਹੈ ਘਰ ਵਿੱਚ ਘਰ ਵਿੱਚ ਫੁੱਲ ਵਾਲੇ ਫਲੈਕਸ ਬੋਰਡ ਲਗਾਕੇ ਉਨ੍ਹਾਂ ਨੂੰ ਵਧੀਆ ਬਣਾ ਸਕਦੇ ਹਾਂ ਮੈਨੂੰ ਮੇਰੇ ਘਰ ਦੀ ਸਜਾਵਟ ਕਰਨਾ ਆਪ ਪਸੰਦ ਹੈ ਕਿਉਂਕਿ ਮੈਨੂੰ ਕਿਸੇ ਦੇ ਹੱਥ ਦਾ ਕੰਮ ਪਸੰਦ ਨਹੀਂ ਆਉਂਦਾ ਕਿਉਂਕਿ ਮੈਨੂੰ ਅ ਕਿਸੇ ਦੇ ਹੱਥ ਦਾ ਕੰਮ ਪਸੰਦ ਨਹੀਂ ਆਉਂਦਾ ਇਸ ਲਈ ਮੈਨੂੰ ਆਪਣਾ ਘਰ ਸਜਾਉਣਾ ਵਧੀਆ ਲੱਗਦਾ ਹੈ ਮੈਂ ਆਪਣੇ ਘਰ ਦੀ ਸਫ਼ਾਈ ਕਰਕੇ ਆਪਣੇ ਘਰ ਨੂੰ ਸਜਾਉਣਾ ਆਪ ਪਸੰਦ ਕਰਦੀ ਹਾਂ ਘਰ ਸਜਾਉਣ ਨਾਲ ਨਵਾਂ ਅਤੇ ਸੋਹਣਾ ਲੱਗਦਾ ਹੈ